ਜੇਕਰ ਪੇਂਡੂ ਖੇਤਰ ਵਿੱਚ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਕਾਫ਼ੀ ਅਲੋਪ ਹੋ ਰਿਹਾ ਹੈ ਪਰ ਖੇਡਾਂ ਨੇ ਇਸ ਨੂੰ ਅਲੋਪ ਹੋਣ ਤੋਂ ਬਚਾਇਆ ਹੈ ਖੇਡਾਂ ਇਸ ਨੂੰ ਅਲੋਪ ਹੋਣ ਬਚਾਉਣ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਹਨ ਮੁੱਢ ਤੋਂ ਚੱਲ ਰਹੀਆਂ ਜਿਵੇਂ ਕਿ ਕਬੱਡੀ ਖੋ ਖੋ ਕੋਟਲਾ ਛਪਾਕੀ ਇਹਨਾਂ ਖੇਡਾਂ ਦੇ ਵ ਕਰਕੇ ਹੀ ਸਾਡਾ ਸ ਪੁਰਾਣਾ ਸੱਭਿਆਚਾਰ ਵੀ ਬਚਿਆ ਹੋਇਆ ਹੈ ਜਦੋਂ ਵੀ ਸਾਡੇ ਖੇਡਾਂ ਜ ਹੁੰਦੀਆਂ ਹਨ ਤਾਂ ਬਾਹਰਲੀ ਸਟੇਟਾਂ ਤੋਂ ਜ਼ਿਲ੍ਹਿਆਂ ਤੋਂ ਵੀ ਲੋਕ ਆਉਂਦੇ ਹਨ ਅਤੇ ਉਹਨਾਂ ਦੇ ਸਵਾਗਤ ਲਈ ਫਿਰ ਰਵਾਇਤੀ ਪ੍ਰੋਗਰਾਮ ਕੀਤੇ ਜਾਂਦੇ ਹਨ ਲੋਕ ਗੀਤ ਕੀਤੇ ਜਾਂਦੇ ਹਨ ਉਹਨਾਂ ਨੂੰ ਫਿਰ ਪੇਂਡੂ ਖਾਣਾ ਹੁੰਦਾ ਹੈ ਜੋ ਸਾਡਾ ਸੱਭਿਆਚਾਰਕ ਪਹਿਲਾਂ ਤੋਂ ਚੱਲਦਾ ਆ ਰਿਹਾ ਉਹ ਪੇਸ਼ ਕੀਤਾ ਜਾਂਦਾ ਹੈ ਇਸ ਨਾਲ ਸਾਡਾ ਸੱਭਿਆਚਾਰ ਫਿਰ ਜਿਊਂਦਾ ਰਹਿੰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਖੇਡਾਂ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ